ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਆਰਤੀ ਮੈਂ ਪਠਾਨਕੋਟ ਤੋਂ ਬੋਲਦੀ ਪਈ ਹਾਂ ਜਿਸ ਤਰ੍ਹਾਂ ਕਿ ਯੋਗਾ ਬਾਰੇ ਦੱਸਿਆ ਜਾਏ ਕਸਰਤ ਬਾਰੇ ਦੱਸਿਆ ਜਾਏ ਯੋਗਾ ਇੱਕ ਬਹੁਤ ਹੀ ਅੱਛੀ ਕਸਰਤ ਹੈ ਜਿਸ ਤਰ੍ਹਾਂ ਕਿ ਪੈ ਯੋਗਾ ਕਰਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਰ ਜਾਂਦੀਆਂ ਨੇ ਕਿਉਂਕਿ ਯੋਗ ਨਾਲ ਮੈਂ ਮੈਂ ਖੁਦ ਆਪ ਯੋਗਾ ਕਰਦੀ ਹਾਂ ਆਪਣੇ ਬੱਚਿਆਂ ਨੂੰ ਯੋਗਾ ਕਰਵਾਉਂਦੀ ਐ ਯੋਗ ਨਾਲ ਸਭ ਕੁਛ ਠੀਕ ਹੋ ਜਾਂਦਾ ਹੈ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਜਿਸ ਤਰ੍ਹਾਂ ਕਿ ਸਰੀਰ ਵਿੱਚ ਜੋ ਵੀ ਬਿਮਾਰੀ ਹੋਏ ਉਹ ਦੂਰ ਹੋ ਜਾਂਦੀ ਹੈ ਕਸਰਤ ਬਾਰੇ ਦੱਸਿਆ ਜਾਏ ਤਾਂ ਕਸਰਤ ਤਾਂ ਇੱਕ ਪੈਦਲ ਜਾਣਾ ਹੈ ਪਸੀਨਾ ਵਹਾਉਣਾ ਜਿਸ ਤਰ੍ਹਾਂ ਕਿ ਪਸੀਨਾ ਅੰਦਰੋਂ ਨਿਕਲਨਾ ਉਹ ਇੱਕ ਅਲੱਗ ਕਸਰਤ ਦਾ ਇੱਕ ਇਮਿਊਨ ਸਿਸਟਮ ਹੈ ਜਿਸ ਤਰ੍ਹਾਂ ਕੇ ਕਸਰਤ ਨਾਲ ਸਿਰਫ਼ ਪਸੀਨਾ ਵਹਾਉਣਾ ਸਾਡਾ ਭਾਰ ਘਟਣਾ ਮੋਟਾਪਾ ਘਟਣਾ ਇਹ ਸਭ ਕੁਛ ਮੰਨਿਆ ਜਾਂਦਾ ਹੈ ਯੋਗਾ ਇੱਕ ਸਾਡੀ ਸਿਹਤ ਨੂੰ ਚੰਗੀ ਤਰ੍ਹਾਂ ਅੱਛਾ ਰੱਖਦਾ ਜਿਸ ਤਰ੍ਹਾਂ ਕਿ ਯੋਗਾ ਕਰਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਜੇਕਰ ਸਾਡਾ ਬਲੱਡ ਸਿਸਟਮ ਠੀਕ ਰਹਿੰਦਾ ਹੈ ਸਭ ਕੁਛ ਠੀਕ ਚਾਲ ਨਾਲ ਚੱਲਦਾ ਹੈ ਜਿੱਦਾਂ ਕਿ ਸਾਡਾ ਖੂਨ ਸੰਘਣਾ ਹੋਵੇ ਯੋਗਾ ਕਰਨ ਨਾਲ ਉਹ ਵੀ ਠੀਕ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਅਸੀਂ ਸਾਹ ਲੈਣਾ ਪ੍ਰੋਬਲਮ ਹੋਏ ਯੋਗ ਨਾਲ ਉਹ ਵੀ ਠੀਕ ਹੋ ਜਾਂਦੀ ਹੈ ਸਿਰ ਦਰਦ ਹੋਏ ਉਹ ਵੀ ਠੀਕ ਹੋ ਜਾਂਦਾ ਹੈ ਯੋਗ ਨਾਲ ਜਿਸ ਤਰ੍ਹਾਂ ਕਿ ਯੋਗਾ ਕਰਨ ਤੋਂ ਹੋਰ ਵੀ ਕਈ ਬਿਮਾਰੀਆਂ ਖਤਮ ਹੁੰਦੀਆਂ ਹੈ ਇਸ ਕਰਕੇ ਸਿਰਫ਼ ਕਸਰਤ ਦਾ ਇੱਕ ਰੂਪ ਹੈ ਯੋਗਾ ਯੋਗਾ ਕਰਨ ਨਾਲ ਬਹੁਤ ਕੁਛ ਦੂਰ ਹੋ ਜਾਂਦਾ ਹੈ ਥੈਂਕ ਊ ਥੈਂਕ ਊ ਸਰ ਓਕੇ